ਸਾਡੇ ਇਲਾਕੇ ਦਾ ਜਿਹੜਾ ਐੱਮ ਐੱਲ ਜਿਹੜੀ ਐੱਮ ਐੱਲ ਏ ਹੈ ਉਹ ਇੱਕ ਮਸ਼ਹੂਰ ਗਾਇਕਾ ਹੈ ਜਿਸਦਾ ਨਾਮ ਹੈ ਅਨਮੋਲ ਗਗਨ ਮਾਨ ਅਤੇ ਉਹ ਪਹਿਲਾਂ ਗੀਤ ਗਾਉਂਦੀ ਸੀਗੀ ਅਤੇ ਬਹੁਤ ਵਧੀਆ ਸਿੰਗਰ ਸੀਗੀ ਪਰ ਨਾਲ਼ ਦੀ ਨਾਲ਼ ਉਹਨੇ ਆਪਣਾ ਇੱਕ ਇਸ ਜਿਹੜੀ ਪੋਲੀਟਿਕਸ ਜਿਹਨੂੰ ਆਪਾਂ ਕਹਿੰਦੇ ਹਾਂ ਉਹਦੇ ਵਿੱਚ ਉਹਨੇ ਆਪਣਾ ਹਿੱਸਾ ਪਾਇਆ ਅਤੇ ਉਹ ਜਦੋਂ ਉਹਦੇ ਵਿੱਚ ਆਈ ਤਾਂ ਉਹ ਸਾਡੇ ਇਲਾਕੇ ਦੀ ਐੱਮ ਐੱਲ ਏ ਚੁਣੀ ਗਈ ਅਤੇ ਜਦੋਂ ਦੀ ਉਹ ਸਾਡੇ ਇਲਾਕੇ ਦੀ ਐੱਮ ਐੱਲ ਏ ਬਣੀ ਹੈ ਉਹਨੇ ਅੱਜ ਤੱਕ ਸਾਡੇ ਇਲਾਕੇ ਵਾਸਤੇ ਕੋਈ ਵੀ ਵਧੀਆ ਕੰਮ ਨਹੀਂ ਕੀਤਾ ਸਿਰਫ਼ ਉਹ ਆਉਂਦੀ ਹੈ ਦੇਖ ਕੇ ਚਲੇ ਜਾਂਦੀ ਹੈ ਅਤੇ ਸਾਡੇ ਵਾਸਤੇ ਕੋਈ ਵੀ ਸੁਵਿਧਾ ਉਹਨੇ ਪ੍ਰਵਾਨ ਨਈ ਕੀਤੀ ਹੈ ਜੇ ਕੋਈ ਉਹਨੂੰ ਕੁਛ ਕਹਿੰਦਾ ਵੀ ਹੈ ਅਸੀਂ ਜੇ ਉਹਦੇ ਨਾਲ਼ ਮਿਲਣ ਵੀ ਜਾਂਦੇ ਹਾਂ ਤਾਂ ਉਹ ਸਾਨੂੰ ਕਦੇ ਵੀ ਚੰਗੇ ਤਰੀਕੇ ਨਾਲ਼ ਨਹੀਂ ਮਿਲਦੀ ਹੈ ਉਹਨੂੰ ਸਾ ਬਸ ਸਾਨੂੰ ਹਮੇਸ਼ਾਂ ਕਹਿ ਦਿੰਦੀ ਹੈ ਕਿ ਹਾਂਜੀ ਠੀਕ ਹੈ ਅਸੀਂ ਤੁਹਾਨੂੰ ਮਿਲਾਂਗੇ ਅਤੇ ਤੁਹਾਡਾ ਕੰਮ ਵੀ ਕਰਾਉਂਗੇ ਪਰ ਜਦੋਂ ਅਸੀਂ ਕਹਿੰਦੇ ਹਾਂ ਉਹਨੂੰ ਕੰਮ ਕਰਨ ਵਾਸਤੇ ਉਹ ਸਾਡਾ ਕੰਮ ਕਦੇ ਵੀ ਨਹੀਂ ਕਰਕੇ ਦਿੰਦੀ ਹੈ ਧੰਨ